ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਨੇ ਇੱਥੋਂ ਦਿਆਂ ਵਿਦਿਆਰਥੀਆਂ ਜਾ ਵਿਦਿਆਰਥਣਾਂ ਲਈ ਬਹੁਤ ਚੰਗੀਆਂ ਸਕੀਮਾਂ ਵੀ ਕੱਢੀਆਂ ਹਨ ਜਿਸ ਕਰਕੇ ਇੱਥੋਂ ਦਿਆਂ ਬੱਚਿਆਂ ਨੂੰ ਪੜ੍ਹਾਈ ਵਿੱਚ ਬਹੁਤ ਮਦਦ ਮਿਲਦੀ ਹਨ ਜੇਕਰ ਕੋਈ ਵੀ ਬੱਚਾ ਦਸਵੀਂ ਜਾਂ ਬਾਰ੍ਹਵੀਂ ਵਿੱਚ ਅਵੱਲ ਦਰਜਾ ਲਿਆਉਂਦਾ ਹੈ ਚਾਹੇ ਨੱਬੇ ਤੋਂ ਪਚਾਨਵੇਂ ਪ੍ਰਸੈਂਟ ਤੋਂ ਉੱਪਰ ਨੰਬਰ ਲੈ ਕੇ ਆਉਂਦਾ ਹੈ ਤਾਂ ਉਸਨੂੰ ਉਸ ਤੋਂ ਅੱਗੇ ਦੀ ਪੜ੍ਹਾਈ ਦਾ ਖਰਚਾ ਸਾਰਾ ਪੰਜਾਬ ਸਰਕਾਰ ਹੀ ਦਿੰਦੀ ਹੈ ਅਤੇ ਏ ਇੱਥੋਂ ਦੀਆਂ ਬੱਚਿਆਂ ਵਾਸਤੇ ਪੰਜਾਬ ਸਰਕਾਰ ਗਰੀਬ ਬੱਚਿਆਂ ਨੂੰ ਪੜ੍ਹਾਈ ਦੇ ਖਰਚੇ ਨਾਲ ਨਾਲ ਉਹਨਾਂ ਨੂੰ ਫਰੀ ਕਿਤਾਬਾਂ ਫਰੀ ਸਕੂਲ ਦੀਆਂ ਵਰਦੀਆਂ ਅਤੇ ਆਉਣ ਜਾਣ ਦੇ ਸਾਧਨਾਂ ਲਈ ਸਾਇਕਲ ਆਦਿ ਚੀਜ਼ਾਂ ਉਪਯੋਗ ਲਈ ਦਿੰਦੀ ਹੈ ਜਿਸ ਕਰਕੇ ਬੱਚੇ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਆਵੇ ਅਤੇ ਉਹ ਇੱਕ ਵਧੀਆ ਸਟੂਡੈਂਟ ਬਣੇ ਇੱਥੋਂ ਦੀਆਂ ਵਿਦਿਆਰਥਣਾਂ ਲਈ ਵੀ ਪੰਜਾਬ ਸਰਕਾਰ ਨੇ ਸਕੀਮਾਂ ਚਲਾਈਆਂ ਹਨ ਜਿਸ ਵਿੱਚ ਬਹੁਤ ਸਾਰੀਆਂ ਵਿਦਿਆਰਥਣਾਂ ਨੇ ਵੀ ਆਪਣੇ ਆਪ ਨੂੰ ਮੁਕੰਮਲ ਕੀਤਾ ਹੈ ਅਤੇ ਉਹਨਾਂ ਸਕੀਮਾਂ ਦੇ ਤਹਿਤ ਆਪ ਨੂੰ ਪੜ੍ਹਾਈ ਵਿੱਚ ਬਹੁਤ ਅੱਗੇ ਲੈ ਕੇ ਗਈਆਂ ਹਨ